ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀ ਦਵਿੰਦਰ ਕੌਰ ਬੋਲਦੇ ਓਂ ਜੀ ਓ ਨਾ ਅਸੀਂ ਦਿੱਲੀ ਤੋਂ ਸਿਫ਼ਟ ਹੋਏ ਹਾਂ ਹੁਣੇ ਹੁਣੇ ਪੰਜਾਬ ਮੈਨੂੰ ਨਾ ਤੁਹਾਡਾ ਨੰਬਰ ਮੇਰੀ ਇੱਕ ਸਹੇਲੀ ਨੇ ਦਿੱਤਾ ਮੈਨੂੰ ਨਾ ਤੁਹਾਡੀ ਮੱਦਦ ਦੀ ਜ਼ਰੂਰਤ ਹੈ ਉਹ ਅਸੀਂ ਆਪਣੀ ਗੱਡੀ ਦੀ ਨਾ ਰਜਿਸਟ੍ਰੇਸ਼ਨ ਨੰਬਰ ਵਗੈਰਾ ਚੇਂਜ ਕਰਵਾਉਣਾ ਹੈ ਪੰਜਾਬ ਦਾ ਕਰਾਉਣਾ ਹੈ ਤਾਂ ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਵੀ ਮੈਂ ਤੁਹਾਡੇ ਨਾਲ਼ ਸੰਪਰਕ ਕਰਲਾਂ ਅਤੇ ਤੁਸੀਂ ਮੇਰੀ ਮੱਦਦ ਕਰਦੂਂਗੇ ਹਾਂਜੀ ਹਾਂ ਹਾਂ ਨਹੀਂ ਨਹੀਂ ਮੋਹਾਲੀ 'ਚ ਏ ਹਾਂ ਅਸੀਂ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਫਿਰ ਮੈਂ ਤੁਹਾਨੂੰ ਦੁਵਾਰਾ ਫ਼ੋਨ ਕਰਾਂ ਕਿ ਤੁਸੀਂ ਮੈਨੂੰ ਕਰਕੇ ਦੱਸਦੋਂਗੇ ਜੀ ਹਾਂਜੀ ਹਾਂ ਇਹ ਮੇਰਾ ਹੀ ਨੰਬਰ ਹੈ ਮੇਰੇ ਕੋਲ ਏ ਰਹਿੰਦਾ ਹਾਂਜੀ ਹਾਂ ਮੈਂ ਅਤੇ ਇਹ ਇਹ ਜਾਣਗੇ ਮੇਰੇ ਨਾਲ਼ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਬਹੁਤ ਬਹੁਤ